ਗੁਡ ਆਫਟਰਨੂਨ ਜੀ ਹਾਂਜੀ ਹਾਂਜੀ ਹਾਂਜੀ ਓਕੇ ਮੈਮ ਨਹੀਂ ਨਹੀਂ ਤੁਸੀਂ ਫਸਟ ਟਰਮ ਦੇ ਲਈ ਬਣਾਏ ਹੋਏ ਆ ਜਾਂ ਫਿਰ ਤਿੰਨੋ ਟਰਮਸ ਦੇ ਬਣਾਏ ਆ ਓਕੇ ਠੀਕ ਹੈ ਕਿੰਨੇ ਚੈਪਟਰਸ ਕੀਤੇ ਮੈਮ ਵਿਚ ਉਹਦੇ 'ਚ ਐਡ ਤੁਸੀਂ ਓਕੇ ਇੱਕ ਵੀਕ ਚੋਂ ਜਾਂ ਇੱਕ ਵੀਕ 'ਚ ਹੋ ਜਾਵੇਗਾ ਜਾਂ ਦੋ ਵੀਕ 'ਚ ਨਹੀਂ ਜੀ ਮੈਨੂੰ ਲੱਗ ਰਿਹਾ ਕਿ ਬੱਚਿਆਂ ਦੇ ਅਕੋਰਡਿੰਗਲੀ ਤਿੰਨ ਚੈਪਟਰ ਇੱਕ ਵੀਕ ਦੇ ਵਿੱਚ ਕਰ ਲੈਣਾ ਐਪਰੋਪ੍ਰੀਏਟ ਜਿਹਾ ਨਹੀਂ ਲੱਗ ਰਿਹਾ ਮੈਨੂੰ ਤੁਸੀਂ ਇੱਦਾਂ ਕਰੋ ਤੁਸੀਂ ਇੱਦਾ ਕਰੋ ਕਿ ਨਾ ਦੋ ਚੈਪਟਰ ਕਰਵਾਓ ਕਿਉਂਕਿ ਦੇਖੋ ਜੇ ਤਾਂ ਚੈਪਟਰ ਆਪਾਂ ਬੱਚਿਆਂ ਕੋਲੋਂ ਰੀਡਿੰਗ ਕਰਵਾਵਾਂਗੇ ਸਭ ਕੁਛ ਕਰਾਂਗੇ ਤਾਂ ਐਟਲੀਸਟ ਇੱਕ ਇੱਕ ਬੱਚੇ ਦੀ ਟਰਨ ਆਉਂਦੀ ਹੈ ਜੇ ਆਪਣੀ ਕਲਾਸ 'ਚ ਥਰਟੀ ਸਟੂਡੈਂਟ ਹੈ ਤਾਂ ਹਰੇਕ ਬੱਚੇ ਦੀ ਟਰਨ ਵੀ ਆਉਣੀ ਜ਼ਰੂਰੀ ਹੈ ਹੈ ਨਾ ਬੱਚਿਆਂ ਦੇ ਵਿੱਚ ਕੋਂਪਲੈਕਸ ਨਹੀਂ ਰਹਿੰਦਾ ਫਿਰ ਅਤੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਕਿ ਹਰੇਕ ਬੱਚੇ ਦੀ ਰੀਡਿੰਗ ਦੇ ਹਿਸਾਬ ਦੇ ਨਾਲ ਇੱਕ ਚੈਪਟਰ ਨੂੰ ਦੋ ਦਿਨ ਲੱਗਣਗੇ ਔਰ ਤੀਸਰੇ ਦਿਨ ਉਹਦੀ ਆਪਾਂ ਬੈਕ ਐਕਸਰਸਾਈਜ ਪਲੱਸ ਕੁਸ਼ਚਨ ਆਨਸਰਜ਼ ਕਰਵਾ ਸਕਦੇ ਹਾਂ ਠੀਕ ਆ ਨਾ ਅਤੇ ਉਸ ਉਸੇ ਹਿਸਾਬ ਨਾਲ ਮਤਲਬ ਆਪਾਂ ਇੱਕ ਵੀਕ ਦੇ ਵਿੱਚ ਦੋ ਚੈਪਟਰ ਕੰਪਲੀਟ ਕਰ ਸਕਦੇ ਹਾਂ ਇਸ ਤੋਂ ਜ਼ਿਆਦਾ ਨਹੀਂ ਹੋ ਸਕਣਗੇ ਹਾਂਜੀ ਹਾਂਜੀ ਬਟ ਇਹ ਦੇਖ ਲੈਣਾ ਇਸ ਚੀਜ਼ ਦਾ ਹਾਂਜੀ ਹਾਂਜੀ ਇਸ ਚੀਜ਼ ਦਾ ਧਿਆਨ ਰੱਖਣਾ ਕਿ ਵਿੱਚ ਹੋਲੀਡੇਜ਼ ਜੇ ਆ ਰਹੀਆਂ ਵਾ ਤਾਂ ਆਪਾਂ ਉਸ ਹਿਸਾਬ ਨਾਲ ਵੀ ਚੱਲਣਾ ਅੱਛਾ ਠੀਕ ਹੈ ਫਿਰ ਤਾਂ ਹਾਂਜੀ ਠੀਕ ਹੈ ਠੀਕ ਹੈ ਦੈਟਸ ਗੁੱਡ ਹਾਂਜੀ ਹੋਰ ਅੱਛਾ ਵੈਲਕਮ ਵੈਲਕਮ ਡੀਅਰ